ਮੈਂ ਮਿਊਚਲ ਫ਼ੰਡ ਕਾਰਡਾਂ ਰਾਹੀਂ ਵੀ ਮੈਨੂੰ ਬੈਂਕ ਤੋਂ ਸਹਾਇਤਾ ਮਿਲਦੀ ਰਹੀ ਹੈ ਮੇਰੀ ਇਸ ਸੰਬੰਧ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਸੀ ਲੇਕਿਨ ਸਮੇਂ ਸਮੇਂ ਅਨੁਸਾਰ ਜਿਸ ਚੀਜ਼ ਦੀ ਮੈਨੂੰ ਲੋੜ ਸੀ ਉਹ ਬੈਂਕ ਵਾਲਿਆਂ ਨੇ ਮੈਨੂੰ ਸਮਝਾਈ ਕਈ ਵਾਰੀ ਮੈਨੂੰ ਅਰਜ਼ੀ ਦੇਣੀ ਪਈ ਅਤੇ ਮੇਰਾ ਉਨ੍ਹਾਂ ਨੇ ਕੰਮ ਵੀ ਕੀਤਾ ਹੈ ਮੇਰਾ ਤਜ਼ਰਬਾ ਬਿਲਕੁਲ ਠੀਕ ਰਿਹਾ